ਹੈਲੋ ਸਰ ਮੈਨੂੰ ਪਾਰਸਲ ਮਿਲਿਆ ਉਹ ਖੁੱਲ੍ਹਿਆ ਹੋਇਆ ਨਹੀਂ ਨਹੀਂ ਖੁੱਲ੍ਹਿਆ ਮਿਲਿਆ ਉਹਦੀ ਪੈਕਿੰਗ ਮੈਂ ਵੀਡੀਓ ਵੀ ਬਣਾਈ ਆ ਉਹਦੀ ਨਹੀਂ ਮੇਰੇ ਕੋਲ ਪਰੂਫ ਹੈ ਅਜਿਹਾ ਹੋ ਹੀ ਨਹੀਂ ਸਕਦਾ ਬਣਾਈ ਹੈ ਮੈਂ ਵੀਡੀਓ ਵੀ ਬਣਾਈ ਅਤੇ ਫੋਟੋ ਵੀ ਖਿੱਚੀ ਆ ਨਹੀਂ ਆ ਗਲਤ ਗੱਲ ਹੈ ਤੁਹਾਡੀ ਤੁਸੀਂ ਖੁੱਲ੍ਹਾ ਦੇ ਤਾ ਪਾਰਸਲ ਮੇਰਾ ਨਹੀਂ ਮੇਰੇ ਕੋਲ ਕੋਈ ਗਲਤੀ ਨਹੀਂ ਆਉਗੀ ਤੁਸੀਂ ਨਹੀਂ ਤੁਸੀਂ ਲਾਪਰਵਾਹੀ ਕੀਤੀ ਆ ਨਹੀਂ ਮੇਰਾ ਪਾਰਸਲ ਖਰਾਬ ਕਰਤਾ ਤੁਸੀਂ ਸਾਰਾ ਓਪਨ ਸੀ ਨਹੀਂ ਨਹੀਂ ਤੁਸੀਂ ਕੀਤਾ ਮੈਂ ਕਿਹਾ ਨਹੀਂ ਨਹੀਂ ਮੇਰੇ ਤੋਂ ਨਹੀਂ ਹੋਇਆ ਮੈਂ ਕਹਿੰਦੀ ਪਈ ਹਾਂ ਨਾ ਤੁਹਾਡੇ ਕੋਲ ਹੀ ਹੋਇਆ ਕਿਉਂ ਨਹੀਂ ਮੇਰੇ ਤੋਂ ਨਹੀਂ ਹੋਈ ਮੈਂ ਤੁਹਾਨੂੰ ਕਹਿੰਦੀ ਪਈ ਹਾਂ ਨਾ ਮੈਂ ਵੀਡੀਓ ਵੀ ਬਣਾ ਲਈ ਹੈ ਚਲੋ ਵੇਖਦੇ ਹਾਂ ਅੱਗੇ ਤੋਂ ਕਿਵੇਂ ਹੋ ਹਮ ਬਹੁਤ ਪਾਰਸਲ ਮੰਗਵਾ ਲਏ ਪਰ ਇਹ ਵਾਲਾ ਓਪਨ ਹੀ ਆਇਆ ਸੀ